ਹੈਲੋ ਹਾਂਜੀ ਹਾਂਜੀ ਜ਼ਰੂਰ ਜੀ ਬੱਚਿਆ ਵਾਸਤੇ ਆਪਣੇ ਕੋਲ ਟੀ ਆਈ ਸਾਈਕਲਸ ਦੇ ਵੀ ਹੈਗੇ ਨੇ ਹੀਰੋ ਸਾਈਕਲਸ ਦੇ ਹੈਗੇ ਨੇ ਐਟਲਸ ਸਾਈਕਲ ਦਾ ਹੈਗਾ ਏ ਵੰਨ ਸਾਈਕਲ ਅਤੇ ਹੈਗੇ ਨੇ ਸਾਰੇ ਵਧੀਆ ਕੁਆਲਿਟੀਜ਼ ਸਾਈਕਲ ਨੇ ਚੌਦ੍ਹਾਂ ਇੰਚੀ ਠੀਕ ਰਹੂ ਉਹ 'ਚ ਗੇਰਾਂ ਵਾਲੇ ਗੇਰਾਂ ਵਾਲੇ ਸਾਈਕਲ ਵੀ ਨੇ ਮੋਟੇ ਟਾਇਰਾਂ ਵਾਲੇ ਵੀ ਨੇ ਨੋਰਮਲ ਸਾਈਕਲ ਵੀ ਨੇ ਸਾਰੇ ਹੈਗੇ ਨੇ ਜਿਹੜਾ ਨੋਰਮਲ ਸਾਈਕਲ ਹੈ ਉਹ ਹੈਗਾ ਪੱਚੀ ਕੁ ਸੌ ਰੁਪਈਏ ਦਾ ਗੇਰਾਂ ਵਾਲਾ ਹੈਗਾ ਫਾਈਵ ਥਾਊਜੈਂਟ ਦਾ ਜਿਹੜੇ ਮੋਟੇ ਟਾਇਰਾਂ ਵਾਲਾ ਟੀ ਆਈ ਸਾਈਕਲ ਦਾ ਇਹ ਹੈਗਾ ਪੈਂਠ੍ਹ ਸੌ ਦਾ ਸੋਲ ਸੌਲ੍ਹਾਂ ਇੰਚੀ ਦਾ ਦੋ ਦੋ ਕੁ ਸੌ ਰੁਪਈਏ ਦਾ ਫਰਕ ਪੈਂਦਾ ਹੁੰਦਾ ਕਿਉਂਕਿ ਬਾਕੀ ਲੋਹਾ ਤਾਂ ਉਹੀ ਹੁੰਦਾ ਸਿਰਫ ਦੋ ਕੁ ਇੰਚ ਮਟੀਰੀਅਲ ਬਰਟੀਕਲ ਨੂੰ ਵੱਧ ਲੱਗਦਾ ਤਾਂ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਦੋ ਦੋ ਸੌ ਐਡ ਕਰ ਲਓ ਡਿਸਕਾਊਂਟ ਤਾਂ ਹੁਣ ਕੰਪਨੀਆਂ ਨੇ ਮਾਰਜਨ ਨਹੀਂ ਛੱਡਿਆ ਜੀ ਡਿਸਕਾਊਂਟ ਕਿੱਥੇ ਦਈਏ ਹੁਣ ਕੰਪਨੀਆਂ ਨੇ ਰੇਟ ਬਹੁਤ ਚੱਕ ਤੇ ਸਾਈਕਲਾਂ ਦੇ ਕੰਪਨੀਆਂ ਨੇ ਰੇਟ ਏ ਬਹੁਤ ਚੱਕ ਤੇ ਪਹਿਲਾਂ ਅਸੀਂ ਪਰ ਸਾਈਕਲ ਪਰ ਸਾਈਕਲ ਦੋ ਕੁ ਸੌ ਰੁਪਈਏ ਦਾ ਗਿਫਟ ਦਾ ਦੇ ਦਿੰਦੇ ਹੁੰਦੇ ਆ ਪਰ ਨਾਲ ਡਿਸਕਾਊਂਟ ਨਹੀਂ ਜੀ ਦਿੰਦੇ ਹੁਣ ਇੱਕ ਤਾਂ ਹਵਾ ਹਵਾ ਭਰਨ ਵਾਲਾ ਪੰਪ ਦੇ ਦਈਦਾ ਅਤੇ ਨਾਲ ਕੋਈ ਪੈਂਚਰ ਲਾਉਣ ਵਾਲਾ ਸਮਾਨ ਦੇ ਦਿੰਦੇ ਹੁਣੇ ਆ ਥੋੜ੍ਹਾ ਜਿਹਾ ਦੋ ਸਾਈਕਲਾਂ 'ਤੇ ਥੋੜ੍ਹਾ ਜਿਹਾ ਕਰ ਦਾਂਗੇ ਉਹ 'ਚ ਪੰਜ ਕੁ ਸੌ ਰੁਪਈਏ ਦਾ ਕਰ ਦਾਂਗੇ ਤੁਹਾਡੇ ਵਾਸਤੇ ਤੁਸੀਂ ਇੰਨਾਂ ਕਹਿ ਰਹੇ ਹੋ ਥੋੜ੍ਹਾ ਬਹੁਤ ਮਾਣ ਤਾਣ ਕਰ ਦਾਂਗੇ ਉਸ ਨਾਲ ਬੈਟਰੀ ਵਾਲਾ ਸਾਈਕਲ ਸਾਡੇ ਕੋਲ ਥੋੜ੍ਹਾ ਜਿਹਾ ਕੋਸਟਲੀ ਹੈ ਜੀ ਏਟੀ ਫਾਈਵ ਹੰਡਰਡ ਤੋਂ ਸਟਾਰਟ ਹੁੰਦੇ ਨੇ ਹਾਂਜੀ ਠੀਕ ਹੈ ਜੀ ਓਕੇ